ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋਰ ਸੁਣਾਓ ਠੀਕ ਠਾਕ ਹਾਂਜੀ ਜ਼ਰੂਰ ਹੋਰ ਸੁਣਾ ਕਿੱਦਾਂ ਘਰ ਪਰਿਵਾਰ ਸਭ ਠੀਕ ਹੈ ਵਧਾਈ ਹੋਵੇ ਫਿਰ ਤਾਂ ਪਰ ਮੈਂ ਕੀ ਕਹਿੰਦੀ ਹਾਂ ਕਿ ਸਾਰੇ ਜਾਣੇ ਬਾਹਰ ਹੀ ਜਾਈ ਜਾਂਦੇ ਆ ਹਾਂ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ

ਹਾਂਜੀ ਸਾਰਿਆਂ ਨੂੰ ਅੱਜ ਕੱਲ੍ਹ ਬਾਹਰ ਜਾਣ ਦੀ ਲੱਗੀ ਆ ਹਾਂਜੀ ਹਾਂਜੀ ਉਹ ਵੀ ਵੈਸੇ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਉਹ ਕਹਿ ਰਿਹਾ ਕਿ ਮੈਂ ਆਈਲੈਟਸ ਕਰਕੇ ਫਿਰ ਬਾਹਰ ਜਾਣਾ ਏ ਪਰ ਮੈਂ ਉਹਨੂੰ ਉਹ ਕਹਿੰਦੇ ਆ ਕਿ ਇੱਥੇ ਓਨੀਆਂ ਓਪਰਚੁਨਟੀਜ਼ ਨਹੀਂ ਹੈਗੀਆਂ ਜਿੰਨੀਆਂ ਬਾਹਰ ਨੇ ਉਨਾਂ ਇੱਥੇ ਕਰੀਅਰ ਨਹੀਂ ਬਣਦਾ ਤਾਂ ਕਰਕੇ ਕਹਿੰਦੇ ਵੀ ਅਸੀਂ ਹਾਂਜੀ ਜੀ ਹੋਰ ਠੀਕ ਹੈ